ਚਾਹ ਚਾਹ ਸਭ ਦੀ ਪਸੰਦਾਇਕ ਹੈਗੀ ਹੈ ਚੀਜ਼ ਹੁਣ ਇਹ ਕਿਉਂ ਜ਼ਿਆਦਾ ਹੁੰਦੀ ਕਿ ਸਭ ਨੂੰ ਜਦੋਂ ਥਕਾਵਟ ਹੋਏ ਕੁਛ ਵੀ ਐਨਰਜੀ ਲੋਅ ਹੋਏ ਉਹਨਾਂ ਨੂੰ ਹੁੰਦਾ ਬਸ ਇੱਕ ਕੜਕ ਜਿਹੀ ਚਾਹ ਮਿਲ ਜਾਏ ਹੁਣ ਜਿੱਦਾਂ ਮੈਂ ਚਾਹ ਬਣਾਉਂਦੀ ਹਾਂ ਮੈਨੂੰ ਤਾਂ ਚਾਹ ਕੜਕ ਪਸੰਦ ਹੈ ਉਹਦੇ ਵਾਸਤੇ ਮੈਂ ਪਹਿਲਾਂ ਪਾਣੀ ਦੇ ਵਿੱਚ ਇੱਕ ਹਰੀ ਇਲਾਇਚੀ ਚੰਗੀ ਤਰ੍ਹਾਂ ਕੁੱਟ ਕੇ ਇੱਕ ਮਿੰਨਟ ਪੂਰਾ ਉਹਨੂੰ ਪਾਣੀ ਦੇ ਵਿੱਚ ਗੜਕਾ ਦਿਵਾਉਂਦੀ ਹਾਂ ਫਿਰ ਮੈਂ ਪੱਤੀ ਪਾਉਂਦੀ ਹਾਂ ਪੱਤੀ ਮੈਂ ਸਟਰੌਂਗ ਹੀ ਰੱਖਦੀ ਹਾਂ ਅਤੇ ਫਿਰ ਪੱਤੀ ਦੇ ਨਾਲ ਜਦੋਂ ਕੜ੍ਹ ਜਾਂਦੀ ਹੈ ਫਿਰ ਮੈਂ ਕਮ ਸੇ ਕਮ ਜਿੱਦਾਂ ਇੱਕ ਕੱਪ ਦੁੱਧ ਲਿਆ ਇੱਕ ਕੱਪ ਪਾਣੀ ਲਿਆ ਤਾਂ ਮੈਂ ਪੌਣਾ ਕੱਪ ਹੀ ਦੁੱਧ ਪਾਉਂਦੀ ਹਾਂ ਮੈਨੂੰ ਚਾਹ ਦੇ ਵਿੱਚ ਦੁੱਧ ਘੱਟ ਪਸੰਦ ਹੈ ਫਿਰ ਉਹਦੇ ਬਾਅਦ ਜਦੋਂ ਉਬਾਲੇ ਆ ਜਾਂਦੇ ਹੈ ਫਿਰ ਜਿੰਨੀ ਕੁ ਚੀਨੀ ਕੁ ਮੈਨੂੰ ਚਾਹੀਦੀ ਹੈ ਅੱਧਾ ਚਮਚ ਇੱਕ ਚਮਚ ਉਹ ਮੈਂ ਪਾ ਕੇ ਇੱਕ ਗੜਕਾ ਫਿਰ ਦਿਵਾਉਂਦੀ ਹਾਂ ਵੈਸੇ ਤਾਂ ਸਾਰੇ ਕਹਿੰਦੇ ਕਿ ਜ਼ਿਆਦਾ ਉਹਨੂੰ ਗੜਕੇ ਨਾ ਦਿਵਾਓ ਕਿਉਂ ਉਹਦੇ ਨਾਲ ਤੁਹਾਨੂੰ ਜਲਨ ਹੋਏਗੀ ਗੈਸ ਬਣੇਗੀ ਪਰ ਪਤਾ ਨਹੀਂ ਮੈਨੂੰ ਕਿੱਦਾਂ ਜਿਹੀ ਆਦਤ ਹੈ ਜਦੋਂ ਤੱਕ ਮੈਂ ਉਹਨੂੰ ਚੰਗੀ ਤਰ੍ਹਾਂ ਸਿਮ 'ਚ ਕਾੜ੍ਹ ਨਾ ਲਵਾਂ ਤਦ ਤਕ ਮੈਨੂੰ ਤਸੱਲੀ ਨਹੀਂ ਹੁੰਦੀ ਤਾਂ ਮੈਨੂੰ ਤਾਂ ਬਈ ਕੜਕ ਚਾਹ ਪਸੰਦ ਹੈ